ਜੇ ਸਾਡੇ ਖੇਤਰ ਦੀ ਗੱਲ ਕੀਤੀ ਜਾਵੇ ਤਾਂ ਇਥੇ ਕਈ ਧਾਰਮਿਕ ਪਰੰਪਰਾਵਾਂ ਹੈਗੀਆਂ ਰੀਤੀ ਰਿਵਾਜ਼ ਨੇ ਜਿਵੇਂ ਕਿ ਸਾਡੇ ਖੇਤਰ ਦੇ ਵਿੱਚ ਇੱਕ ਭੈਰੋਂ ਦਾ ਮੰਦਿਰ ਹੈ ਉਥੇ ਦਾਰੂ ਚੜਦੀ ਆ ਬਾਈ ਉਦਾਂ ਜੇ ਦੇਖਿਆ ਜਾਵੇ ਤਾਂ ਦਾਰੂ ਮਾੜੀ ਚੀਜ਼ ਹੈ ਉਥੇ ਲੋਕ ਮੱਥਾ ਟੇਕਦੇ ਆ ਉਹਦੇ ਬਾਅਦ ਉਹਨੂੰ ਭੋਗ ਦੇ ਤੌਰ 'ਤੇ ਵੰਡੀ ਵੀ ਜਾਂਦੀ ਹੈ ਇਹ ਤੋਂ ਇਲਾਵਾ ਫਿਰ ਸਾਡੇ ਇੱਥੇ ਇੱਕ ਇਲਾਕੇ 'ਚ ਨੇੜੇ ਹੀ ਪਿੰਡ ਬਿੰਦਰਖ ਹੈ ਅਤੇ ਉੱਥੇ ਹਰੇਕ ਐਤਵਾਰ ਨੂੰ ਸੋਹਣਾ ਇਕੱਠ ਹੁੰਦਾ ਜਾਨੀ ਕਿ ਕਹਿੰਦੇ ਉੱਥੇ ਸੁੱਖਨਾ ਸੁੱਖੀਆ ਵੀਆਂ ਪੂਰੀਆਂ ਹੋ ਜਾਂਦੀਆਂ ਮੰਨਤਾਂ ਮੁੰਨਤਾਂ ਪੂਰੀਆਂ ਹੁੰਦੀਆਂ ਇਦਾਂ ਕਰਕੇ ਹੈ ਤਾਂ ਉਹਦੇ ਕਰਕੇ ਉਥੇ ਵੀ ਇੱਕ ਬਾਬਾ ਅਮਰਨਾਥ ਜੀ ਹੋਏ ਨੇ ਉਹਨਾਂ ਦੀ ਵੀ ਜਾਣੀ ਕਿ ਖਾਸੀ ਮਾਨਤਾ ਏ ਅਤੇ ਉਹ ਤੋਂ ਇਲਾਵਾ ਜੇ ਗੱਲ ਕਰੀ ਜਾਵੇ ਯਾਤਰਾਵਾਂ ਦੀ ਤਾਂ ਸਿੱਖ ਧਰਮ ਦੇ ਨਾਲ ਸੰਬੰਧਿਤ ਹੋਲੇ ਮਹੱਲੇ ਦੀ ਯਾਤਰਾ ਏ ਉਹ ਤੋਂ ਇਲਾਵਾ ਫਿਰ ਸ਼ਹੀਦੀ ਜੋੜ ਮੇਲ ਹੈ ਉਹਤੋਂ ਇਲਾਵਾ ਫਿਰ ਇੱਕ ਨੈਣਾ ਦੇਵੀ ਦੀ ਯਾਤਰਾ ਹੁੰਦੀ ਹੈ ਉਹ ਆਹਾ ਸਾਉਣ ਦੇ ਮਹੀਨੇ ਚੱਲਦੀ ਹੈ